ਹੈਲੋ ਸਤਿ ਸ਼੍ਰੀ ਅਕਾਲ ਜੀ ਮੈਨੂੰ ਗਰੰਸ਼ ਨੇ ਨੰਬਰ ਦਿੱਤਾ ਸੀ ਤੁਹਾਡਾ ਅਸੀਂ ਬੱਚਿਆਂ ਨੂੰ ਘੁੰਮਾਉਣ ਵਾਸਤੇ ਲੈ ਕੇ ਆਏ ਸੀ ਮਾਨਸਾ ਘੁੰਮਾਉਣ ਵਾਸਤੇ ਲੈ ਕੇ ਆਏ ਸੀ ਔਰ ਬੱਚੇ ਮੂਵੀ ਦੇਖ ਮੂਵੀ ਦੇਖਣ ਦੀ ਜਿੱਦ ਕਰ ਰਹੇ ਸੀ ਇਸ ਲਈ ਕੱਲ੍ਹ ਸਿਨੇਮਾ ਚੱਲ ਵੜਾਂਗੇ ਨਾਇਟ ਵਾਲਾ ਠੀਕ ਹੈ ਜੀ ਪੰਜ ਜਾਣੇ ਠੀਕ ਹੈ ਜੀ ਹੋਟਲ 'ਚ ਪੈਰਾਡਾਈਜ਼ ਠੀਕ ਹੈ